ਮੇਰੇ ਬੱਚਿਆਂ ਨੂੰ ਦਾਲ ਚਾਵਲ ਬਹੁਤ ਜ਼ਿਆਦਾ ਪਸੰਦ ਹੈ ਅੱਜ ਸੰਡੇ ਐਤਵਾਰ ਸੀਗਾ ਅਤੇ ਬੱਚੇ ਕਹਿੰਦੇ ਮੰਮਾ ਅੱਜ ਟਾਈਮ ਵੀ ਹੈਗਾ ਤਾਂ ਸਾਨੂੰ ਦਾਲ ਚਾਵਲ ਬਣਾ ਕੇ ਦਿਓ ਪੰਜ ਰਤਨ ਦਾਲ ਉਹਨਾਂ ਨੂੰ ਬਹੁਤ ਪਸੰਦ ਹੈ ਜਿਵੇਂ ਉਹ 'ਚ ਮੂੰਗੀ ਛੋਲੇ ਮਸਰ ਅਰਹਰ ਅਤੇ ਮੋਠ ਦੀ ਦਾਲ ਰਲਾ ਕੇ ਅਤੇ ਮੈਂ ਵਧੀਆ ਦਾਲ ਭੇਅ ਕੇ ਰੱਖੀ ਦੋ ਘੰਟੇ ਪਹਿਲਾਂ ਦਾਲ ਬਣਾਈ ਬਹੁਤ ਵਧੀਆ ਉਹਨੂੰ ਤੜਕਾ ਤੁੜਕਾ ਲਗਾਇਆ ਬਹੁਤ ਸੋਹਣੀ ਮਤਲਬ ਦਾਲ ਬਣੀ ਬਣ ਰਹੀ ਸੀਗੀ ਅਤੇ ਵਿੱਚ ਮੈਨੂੰ ਫੋਨ ਆ ਗਿਆ ਹਜੇ ਤੜਕਾ ਪਾਉਣ ਤੋਂ ਪਹਿਲਾਂ ਹੀ ਮੈਂ ਉਹਦੇ ਵਿੱਚ ਨਮਕ ਸ਼ਾਇਦ ਪਾ ਤਾ ਸੀਗਾ ਪਹਿਲਾਂ ਹੀ ਅਤੇ ਪਰ ਮੈਂ ਫੋਨ 'ਤੇ ਗੱਲ ਕਰਨ ਲੱਗੀ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਨਮਕ ਪਾਇਆ ਕਿ ਨਹੀਂ ਮੈਂ ਉਹ 'ਚ ਨਮਕ ਹੋਰ ਪਾ ਦਿੱਤਾ ਅਤੇ ਬੱਚੇ ਖਾਣੇ ਲਈ ਜਲਦੀ ਮਚਾ ਰਹੇ ਸੀਗੇ ਮੈਂ ਕਿਹਾ ਚਲ ਦਾਲ ਇੱਕ ਵਾਰ ਮਾੜੀ ਟੇਸਟ ਕਰਕੇ ਦੇਖ ਲਾ ਜਦੋਂ ਟੇਸਟ ਕੀਤੀ ਉਹ ਤਾਂ ਬਿਲਕੁਲ ਹੀ ਖਾਰੀ ਬਣ ਗਈ ਬਿਲਕੁਲ ਖਾਣ ਦੇ ਲਾਇਕ ਹੀ ਨਹੀ ਸੀ ਅਤੇ ਘਰ ਹੋਰ ਕੋਈ ਸਬਜ਼ੀ ਵੀ ਨਹੀਂ ਪਈ ਸੀ ਅਤੇ ਬੱਚੇ ਵੀ ਹੱਲਾ ਮਚਾ ਰਹੇ ਸੀਗੇ ਫਿਰ ਮੈਂ ਕੀ ਕੀਤਾ ਮੈਨੂੰ ਯੂਟੀਊਬ 'ਤੇ ਇੱਕ ਵਾਰ ਦੇਖਿਆ ਸੀਗਾ ਕਿ ਦਾਲ 'ਚ ਜੇ ਕਿਸੇ ਸਬਜ਼ੀ 'ਚ ਨਮਕ ਜ਼ਿਆਦਾ ਪੈ ਜਾਵੇ ਤਾਂ ਆਟੇ ਦੀਆਂ ਲੋਈਆਂ ਉਹਦੇ ਵਿੱਚ ਪਾ ਦਿਓ ਤਾਂ ਤਾਂ ਮੈਂ ਉਹ ਐਕਸਪੈਰੀਮੈਂਟ ਕਰਕੇ ਦੇਖਿਆ ਉਹ 'ਚ ਆਟੇ ਦੀਆਂ ਲੋਈਆਂ ਪਾਈ ਪਾਈਆਂ ਅਤੇ ਨਮਕ ਉਹਦੇ ਨਾਲ ਘੱਟ ਹੋ ਗਿਆ ਅਤੇ ਬੱਚਿਆਂ ਨੇ ਵੀ ਵਧੀਆ ਖੁਸ਼ ਹੋ ਕੇ ਦਾਲ ਖਾਦੀ